ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੀ ਉਮਰ ਅਠਾਰਾਂ ਸਾਲ ਹੈ ਹੋਟਲ ਅਤੇ ਹੋਟਲ ਦੇ ਵਰਗੇ ਵਿਕਲਪ ਇਹ ਸਭ ਕੁਛ ਯਾਤਰਾ 'ਤੇ ਹੀ ਨਿਰਭਰ ਕਰਦਾ ਹੈ ਕਿਉਂਕਿ ਯਾਤਰਾ 'ਤੇ ਹੀ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਹੋਟਲਾਂ ਜਾਂ ਫਿਰ ਉਹਦੇ ਵਰਗੇ ਹੋਰ ਵਿਕਲਪਾਂ ਦੀ ਲੋੜ ਪਵੇਗੀ ਕਿਉਂਕਿ ਕਈ ਵਾਰ ਜਦੋਂ ਤੁਹਾਡਾ ਸਰੀਰ ਪਹਾੜ ਵਗੈਰਾ ਚੜ੍ਹਨ 'ਤੇ ਬਹੁਤ ਜ਼ਿਆਦਾ ਥੱਕ ਜਾਂਦਾ ਹੈ ਅਤੇ ਤੁਸੀਂ ਸੋਚਦੇ ਹੋ ਕਿ ਇਸ ਵਾਰ ਹੋਟਲ ਹੀ ਲੈ ਲਿਆ ਜਾਵੇ ਤਾਂ ਕਿ ਤੁਹਾਨੂੰ ਨੀਂਦ ਬਹੁਤ ਵਧੀਆ ਆਵੇ ਹੋਟਲ ਕਿਉਂਕਿ ਹੋਟਲ ਵਿੱਚ ਹੋਰ ਵੀ ਸੁਵਿਧਾਵਾਂ ਹੁੰਦੀਆਂ ਹਨ ਪਰ ਜਦੋਂ ਤੁਸੀਂ ਸਿਰਫ਼ ਕਿਸੇ ਜਗ੍ਹਾ ਦੀ ਖੂਬਸੂਰਤੀ ਵਗੈਰਾ ਵੇਖਣ ਜਾਂਦੇ ਹੋ ਅਤੇ ਉਹ ਹੋਟਲ ਦੇ ਹੋਰ ਵਿਕਲਪ ਵੀ ਕਾਫ਼ੀ ਵਧੀਆ ਭੂਮਿਕਾ ਨਿਭਾਉਂਦੇ ਹਨ ਜਿਸ ਵਿੱਚ ਕਿ ਤੁਹਾਨੂੰ ਖ਼ਰਚਾ ਵੀ ਘੱਟ ਆਉਂਦਾ ਹੈ ਅਤੇ ਤੁਹਾਡੇ ਕੋਲ ਰਹਿਣ ਲਈ ਵੀ ਇੱਕ ਵਧੀਆ ਜਗ੍ਹਾ ਹੁੰਦੀ ਹੈ ਲੇਕਿਨ ਹੋਟਲ ਅਤੇ ਹੋਟਲਾਂ ਦੇ ਵਰਗੇ ਵਿਕਲਪ ਇਹ ਸਫਰ 'ਤੇ ਹੀ ਨਿਰਭਰ ਕਰਦੇ ਹਨ